ਰੀਸੈਂਟਲੀ ਜੋ ਮੈਂ ਬੁੱਕ ਪੜ੍ਹੀ ਹੈ ਉਸਦਾ ਨਾਮ ਹੈ ਪੇਸ਼ੈਂਸ਼ ਉਸ 'ਚ ਜੋ ਲੜਕੀ ਹੁੰਦੀ ਹੈ ਉਸ ਨਾਲ ਇਸ ਤਰ੍ਹਾਂ ਮਤਲਬ ਇਸ ਇਸ ਤਰ੍ਹਾਂ ਦੀਆਂ ਘਟਨਾ ਹੋਈਆਂ ਕਿ ਉਹ ਉਹ ਰੋ ਵੀ ਸਕਦੀ ਸੀ ਪਰ ਉਸਦਾ ਜਿਹੜਾ ਸਬਰ ਹੈ ਉਹੀ ਉਸ 'ਚ ਦਰਸਾਇਆ ਗਿਆ ਹੈ ਜਿਸ ਕਰਕੇ ਮੈਨੂੰ ਬਹੁਤ ਹੀ ਭਾਵੁਕ ਖਿਆਲ ਆਏ ਸਨ